ਮੈਂ ਓਫਿਸ ਦੇ ਵਿੱਚ ਆਪਣੀ ਇੱਕ ਪੇਸ਼ਕਾਰੀ ਦੇ ਰਿਹਾ ਸੀ ਅਚਾਨਕ ਹੀ ਉਸ ਸਮੇਂ ਬਿਜਲੀ ਚਲੀ ਜਾਂਦੀ ਹੈ ਅਤੇ ਮੇਰਾ ਜੋ ਸਲਾਈਡ ਸ਼ੋ ਹੈ ਉਹ ਬੰਦ ਹੋ ਜਾਂਦਾ ਹੈ ਫਿਰ ਮੈਂ ਮੇਰੇ ਕੋਲ ਐਮਰਜੈਂਸੀ ਹੋਟਲਾਈਨ ਨੰਬਰ ਸੀ ਸੋ ਮੈਂ ਉਸ 'ਤੇ ਕੌਲ ਕੀਤਾ ਅਤੇ ਮੈਂ ਉਸ ਬਿਲਡਿੰਗ ਦੇ ਪ੍ਰਬੰਧਕ ਨੂੰ ਕਿਹਾ ਕਿ ਕਿ ਜੋ ਇਸ ਚੀਜ਼ ਬਾਰੇ ਜਾਣਦੇ ਸਨ ਮੈਂ ਕਿਹਾ ਕਿ ਬਿਜਲੀ ਜਲਦ ਤੋਂ ਜਲਦ ਦਵਾਈ ਜਾਏ ਤਾਂ ਕਿ ਮੇਰੇ ਬਹੁ ਬਹੁਤ ਹੀ ਜ਼ਿਆਦਾ ਜ਼ਰੂਰੀ ਜੋ ਕਿ ਮੇਰੀ ਪੇਸ਼ਕਾਰੀ ਹੈ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਮੈਂ ਉਸਦੀ ਰਿਪੋਟ ਕੀਤੀ ਅਤੇ ਅਨੁਰੋਧ ਕੀਤਾ ਕਿ ਇਸਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਏ ਸਮੇਂ ਸਿਰ ਤਾਂ ਕਿ ਮੈਂ ਆਪਣੀ ਪੇਸ਼ਕਾਰੀ ਨੂੰ ਪੇਸ਼ ਕਰ ਸਕਾਂ ਥੈਂਕ ਯੂ ਸੋ ਮੱਚ